ਹਾਂਜੀ ਮੈਂ ਦੱਸਣਾ ਚਾਹਾਂਗੀ ਕਿ ਜਿਵੇਂ ਸ਼ਿਫੋਨ ਦੇ ਕੱਪੜੇ ਹੋਗੇ ਪਿਓਰ ਦੇ ਕੱਪੜੇ ਹੋਗੇ ਇਹਨਾਂ 'ਚ ਮੈਨੂੰ ਸਟਾਰਟਿੰਗ ਦੇ ਵਿੱਚ ਜਿਵੇਂ ਮੈਂ ਲਹਿੰਗੇ ਬਣਾਉਣੇ ਮੈਨੂੰ ਬਹੁਤ ਹੀ ਔਖੇ ਲੱਗੇ ਕਿਉਂਕਿ ਮੈਂ ਕਦੇ ਬਣਾਏ ਹੀ ਨਹੀਂ ਸੀ ਹੋਏ ਚਲੋ ਮੈਂ ਹੌਲੀ ਹੌਲੀ ਮਤਲਬ ਜਿਵੇਂ ਉਹਨੂੰ ਕਟਿੰਗ ਕੀਤੀ ਉਹ ਕੱਪੜਾ ਜਿਹੜਾ ਏ ਉਹ ਜ ਵੱਧ ਤੋਂ ਵੱਧ ਫੈਲ ਜਾਂਦਾ ਏ ਅਤੇ ਚਲੋ ਮੈਂ ਇੱਕ ਦੋ ਵਾਰੀ ਮੈਨੂੰ ਉਧੇੜਨਾ ਵੀ ਪਿਆ ਇਹ ਕੱਪੜਾ ਮੇਰੇ ਲਈ ਬਹੁਤ ਚੁਣੌਤੀ ਵਾਲਾ ਸੀ ਸਿਲਨਾ ਮੈਂ ਕਿੰਨੀ ਵਾਰੀ ਦੇੜਿਆ ਪਰ ਇਹ ਕੀ ਕਲੀਆਂ ਵੀ ਮੈਨੂੰ ਉਧੇੜਣੀਆਂ ਪਈਆਂ ਉਹਦੀਆਂ ਕਿੰਨੀ ਵਾਰੀ ਚਲੋ ਮੈਂ ਉਧੇੜੀਆਂ ਫਿਰ ਮੈਂ ਜੋੜੀਆਂ ਪਰ ਉਹ ਲਾਸਟ ਦੇ ਵਿੱਚ ਜੋ ਹੈ ਇਸ ਤਰ੍ਹਾਂ ਕਰ ਕਰਕੇ ਇੱਕ ਅਭਿਆਸ ਦੇ ਨਾਲ ਜੋ ਹੈ ਮੈਂ ਉਹਨੂੰ ਬਣਾ ਲਿਆ ਪਰ ਉਹ ਮੇਰੇ ਲਈ ਇੱਕ ਚੰਗਾ ਵੀ ਰਿਹਾ ਚੰਗਾ ਇਸ ਲਈ ਰਿਹਾ ਕਿਉਂਕਿ ਇੱਕ ਤਾਂ ਮੇਰਾ ਇਹ ਫੀਲਡ ਸੀ ਠੀਕ ਹੈ ਅਤੇ ਮੈਂ ਉਹਨੂੰ ਇੱਕ ਮਤਲਬ ਚੰਗੇ ਤਰੀਕੇ ਨਾਲ ਮੈਂ ਉਹਨੂੰ ਸਿੱਖਣਾ ਚਾਹੁੰਦੀ ਸੀ ਕਿ ਤਾਂ ਜੋ ਮੇਰੇ ਕੋਲ ਅੱਗੇ ਗਲਤੀ ਨਾ ਹੋਵੇ ਉਸ ਉਸ ਲਾਈਨ ਤੋਂ ਮੈਂ ਉਸ ਚੀਜ਼ ਤੋਂ ਮੈਂ ਇਹ ਸਿੱਖਿਆ ਕਿ ਮੈਂ ਇ ਇਹਨੂੰ ਦੁਬਾਰਾ ਜੋ ਹੈ ਉਹ ਗਲਤੀਆਂ ਨਾ ਦੁਹਰਾ ਸਕਾਂ ਜਿਹੜੀਆਂ ਗਲਤੀਆਂ ਉਹ ਆਪਣੇ ਮਾਇੰਡ 'ਚ ਰੱਖ ਲਈਆਂ ਕਿ ਅੱਗੇ ਤੋਂ ਮੈਂ ਇਹ ਗਲਤੀ ਨਹੀਂ ਕਰਨੀ ਹੈਗੀ ਠੀਕ ਹੈ ਅਤੇ ਮੈਂ ਉਹਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਜੋ ਹੈ ਦੂਸਰੀ ਵਾਰੀ ਮੈਂ ਉਹਨੂੰ ਤਿਆਰ ਕਰ ਲਿਆ ਇਸ ਤੋਂ ਇਲਾਵਾ ਹੁਣ ਮੈਂ ਉਹ ਬਹੁਤ ਚੰਗੇ ਤਰੀਕੇ ਨਾਲ ਬਣਾ ਲੈਂਦੀ ਹਾਂ ਅਤੇ ਆਪਣੇ ਮੇਰੇ ਕਸਟਮਰ ਜੋ ਹੈ ਮੇਰੇ ਤੋਂ ਬਹੁਤ ਸੈਟਿਸਫਾਈ ਹੁੰਦੇ ਨੇ ਕਿ ਇਹ ਬਹੁਤ ਸੋਹਣੇ ਬਣਾਉਂਦੇ ਨੇ ਉਸ ਤੋਂ ਬਾਅਦ ਪਹਿਲੀ ਵਾਰੀ ਤਾਂ ਮੈਨੂੰ ਮੁਸ਼ਕਿਲ ਲੱਗਾ ਲੇਕਿਨ ਹੁਣ ਉਸ ਤੋਂ ਬਾਅਦ ਜੋ ਹੈ ਮੈਨੂੰ ਘੱਟੋ ਘੱਟ ਚਾਲ੍ਹੀ ਪੰਜਾਹ ਇਹੋ ਜਿਹੇ ਲਹਿੰਗੇ ਆਏ ਆ ਕਲੀਆਂ ਵਾਲੇ ਜਿਹਨਾਂ ਦੀ ਮੈਂ ਸਟਿਚਿੰਗ ਕਰਕੇ ਉਹਨਾਂ ਲੋਕਾਂ ਨੂੰ ਦਿੱਤੀ ਅਤੇ ਉਹ ਲੋਕ ਮੇਰੇ ਤੋਂ ਬਹੁਤ ਖੁਸ਼ ਹੋ ਰਹੇ ਨੇ ਅਤੇ ਇਸ ਤੋਂ ਇਲਾਵਾ ਹੋਰ ਵੀ ਔਡਰ ਦੇ ਰਹੇ ਨੇ ਅਤੇ ਸ ਚਲੋ ਉਸ ਟਾਈਮ 'ਤੇ ਮੇਰੇ ਲਈ ਇਹ ਚੁਣੌਤੀਪੂਰਨ ਸੀ ਪਰ ਮੈਂ ਇਸ ਚੀਜ਼ ਤੋਂ ਬਹੁਤ ਕੁਛ ਸਿੱਖ ਲਿਆ ਅਤੇ ਆਪਣੇ ਜੀਵਨ 'ਚ ਉਤਾਰਿਆ ਅਤੇ ਮੈਂ ਬਹੁਤ ਖੁਸ਼ ਹਾਂ